ਲੋਕ ਵਿਆਹ 'ਤੇ ਲਾੜੀ ਨੂੰ ਵੱਖ ਵੱਖ ਤਰ੍ਹਾਂ ਦੇ ਤੋਹਫੇ ਦਿੰਦੇ ਹਨ ਉਸਦੇ ਰਿਸ਼ਤੇਦਾਰ ਉਸਦੇ ਭੈਣ ਭਰਾ ਸਾਰੇ ਉਹਨੂੰ ਵੱਖ ਵੱਖ ਤਰੀਕੇ ਦੇ ਤੋਹਫੇ ਦਿੰਦੇ ਹਨ ਦਾਜ ਦੇ ਰੂਪ 'ਤੇ ਉਸਨੂੰ ਗੱਡੀ ਵੋਸ਼ਿੰਗ ਮਸ਼ੀਨ ਟੀ ਵੀ ਫਰਿੱਜ ਏ ਸੀ ਕੂਲਰ ਸੋਫੇ ਗੱਦੇ ਸਭ ਕੁਛ ਦਿੱਤਾ ਜਾਂਦਾ ਹੈ ਜੋ ਕਿ ਉਹਦੇ ਘਰਦਿਆਂ ਵੱਲੋਂ ਉਹਦੇ ਲਈ ਬਹੁਤ ਹੀ ਪਿਆਰ ਹੁੰਦਾ ਹੈ ਕੁੜੀ ਦੇ ਘਰ ਦੇ ਉਸਨੂੰ ਬਹੁਤ ਹੀ ਮਾਣ ਸਤਿਕਾਰ ਨਾਲ ਸਮਾਨ ਭੇਜਦੇ ਹਨ ਤਾਂ ਕਿ ਉਹ ਆਪਣੇ ਸਹੁਰੇ ਜਾ ਕੇ ਕਿਸੇ 'ਤੇ ਬੋਝ ਨਾ ਬਣ ਸਕੇ ਅਤੇ ਆਪਣਾ ਸਮਾਨ ਖੁਦ ਯੂਜ਼ ਕਰ ਲਵੇ ਅਤੇ ਲ ਲਾੜੀ ਦੇ ਘਰਦੇ ਉਸਨੂੰ ਉਸਨੂੰ ਅਤੇ ਉਸਦੇ ਘਰ ਵਾਲੇ ਨੂੰ ਉਸਦੇ ਪਰਿਵਾਰ ਨੂੰ ਉਸਦੇ ਰਿਸ਼ਤੇਦਾਰਾਂ ਨੂੰ ਬਹੁਤ ਸਮਾਨ ਦਿੰਦੇ ਹਨ ਸੋਨੇ ਚਾਂਦੀ ਦੇ ਗਹਿਣੇ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਲਾੜੀ ਨੂੰ ਸਮਾਨ ਦਿੰਦੇ ਹਨ ਬਹੁਤ ਹੀ ਕੋਈ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਉਸਦੇ ਲਾੜੇ ਨੂੰ ਸਮਾਨ ਦਿੰਦੇ ਹਨ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਸਭ ਨੂੰ ਦਿੱਤੇ ਜਾਂਦੇ ਹਨ ਕੁੜੀ ਦੇ ਘਰਦਿਆਂ ਵੱਲੋਂ ਇਹ ਸਾਰਾ ਮਾਣ ਸਤਿਕਾਰ ਉਸ ਦੀ ਕੁੜੀ ਖੁਸ਼ ਰਹੇ ਇਸ ਲਈ ਦਿੱਤਾ ਜਾਂਦਾ ਹੈ ਅਤੇ ਬਹੁਤ ਹੀ ਮਾਣ ਸਤਿਕਾਰ ਨਾਲ ਉਹਨੂੰ ਦਾਜ ਦਿੱਤਾ ਜਾਂਦਾ ਹੈ ਤਾਂ ਕਿ ਉਹ ਕਿਸੇ 'ਤੇ ਬੋਝ ਨਾ ਬਣ ਸਕੇ